ਦਸਤਕਾਰੀ ਜਾਂ ਯਾਦਗਾਰੀ ਚਿੰਨ੍ਹ ਉਹ ਹੁੰਦੇ ਹਨ ਜਿਹੜੇ ਸਾਨੂੰ ਸਾਡੀ ਦਗਾ ਜਾਂ ਸਾਡੇ ਕਲਚਰ ਦੀ ਯਾਦ ਦਿਵਾਉਂਦੇ ਹਨ ਜਿਵੇਂ ਕਿ ਟ ਕੱਪੜੇ ਗਹਿਣੇ ਮਿੱਟੀ ਦੇ ਬਰਤਨ ਆਦਿ ਇਹ ਸਾਰੀ ਚੀਜ਼ਾਂ ਉਹ ਹਨ ਜਿਹੜੀਆਂ ਸਾ ਜਿਹਨੂੰ ਵੇਖ ਕੇ ਸਾਨੂੰ ਸਾਡੇ ਲੋਕਾਂ ਦੀ ਸਾਡੇ ਕਲਚਰ ਦੀ ਸਾਡੇ ਥਾਵਾਂ ਦੀ ਯਾਦ ਆਉਂਦੀ ਹੈ ਜਦੋਂ ਲੋਕ ਬ ਬਾਹਰ ਕਿਤੇ ਜਾਂਦੇ ਹੈ ਜਾਂ ਆਪਦੀ ਥਾਂ ਜਗ੍ਹਾ ਤੋਂ ਦੂਰ ਦਰਾਜ 'ਚ ਕਿਤੇ ਜਾਂਦੇ ਹੈ ਤਾਂ ਉਹ ਇਹ ਸਾਰੀਆਂ ਚੀਜ਼ਾਂ ਨੂੰ ਆਪਣੇ ਨਾਲ ਲੈ ਕੇ ਜਾਂਦੇ ਹਨ ਤਾਂ ਕਿ ਜੋ ਉਹਨਾਂ ਨੂੰ ਆਪਣੀ ਥਾਂ ਦੀ ਆਪਣੇ ਕਲਚਰ ਦੀ ਯਾਦ ਦਿਵਾ ਸਕੇ ਜਿਵੇਂ ਲੋਕ ਜਦੋਂ ਲੋਕ ਫੋਰਨ ਜਾਂਦੇ ਹਨ ਤਾਂ ਉਹ ਪੰਜਾਬ ਦੀਆਂ ਯਾਦਗਾਰੀ ਚੀਜ਼ਾਂ ਨਾਲ ਲੈ ਕੇ ਜਾਂਦੇ ਹਨ ਜਿਵੇਂ ਕਿ ਕੱਪੜੇ ਹੋ ਗਏ ਕੱਪਲ ਕੱਪੜੇ ਹੋ ਗਏ ਜ ਗਹਿਣੇ ਹੋ ਗਏ ਮਿੱਟੀ ਦੇ ਬਰਤਨ ਹੋ ਗਏ ਅਤੇ ਕੱਪੜਿਆਂ ਵਿੱਚ ਵੀ ਜਿਵੇਂ ਫੁਲਕਾਰੀ ਹੋ ਗਏ ਪਾਕਿਸਤਾਨੀ ਦੁਪੱਟੇ ਹੋ ਗਏ ਪੰਜਾਬੀ ਸੂਟ ਹੋ ਗਏ ਜੁੱਤੀਆਂ ਹੋ ਗਈਆਂ ਇਹ ਸਾਰੀਆਂ ਚੀਜ਼ਾਂ ਉਹ ਲੈ ਕੇ ਜਾਂਦੇ ਹਨ ਤਾਂ ਕਿ ਉਹ ਉੱਥੇ ਦੇ ਲੋਕਾਂ ਨੂੰ ਆਪਣੇ ਕਲਚਰ ਆਪਣੇ ਜਗ੍ਹਾ ਆਪਣੇ ਦੇਸ਼ ਬਾਰੇ ਦੱਸ ਸਕਣ ਜੇ ਤੇ ਯਾਦਗਾਰ ਚੀਜ਼ਾਂ ਵਿੱਚ ਗਹਿਣੇ ਵੀ ਆ ਸਕਦੇ ਹਨ ਜਿਵੇਂ ਕਿ ਹੱਥ 'ਚ ਪਾਉਣ ਵਾਲੀ ਚੂੜੀਆਂ ਝਾਂਜਰਾਂ ਸੈਟ ਆ ਇਹ ਸਾਰੇ ਵੀ ਯਾਦਗਾਰ ਚੀਜ਼ਾਂ ਹਨ ਜਿਨ੍ਹਾਂ ਨੂੰ ਵੇਖ ਕੇ ਲੋਕ ਆਪਣੇ ਲੋ ਜਗ੍ਹਾ ਜਾਂ ਆਪਣੇ ਕਲਚਰ ਨੂੰ ਯਾਦ ਕਰਦੇ ਹਨ ਮਿੱਟੀ ਦੇ ਬਰਤਨ ਜਿਵੇਂ ਘੜਾ ਗੋਲਕ ਸੁਰਾਹੀ ਕੁੰਨੀ ਇਹ ਸਾਰੀਆਂ ਚੀਜ਼ਾਂ ਵੀ ਲੋਕ ਆਪਣੇ ਨਾਲ ਲੈ ਕੇ ਜਾ ਸਕਦੇ ਹਨ ਜਿਨ੍ਹਾਂ ਨੂੰ ਵੇਖ ਕੇ ਉਹਨਾਂ ਨੂੰ ਆਪਣੇ ਥਾਵਾਂ ਦੀ ਯਾਦ ਆਉਂਦੀ ਹੈ ਅਤੇ ਸਾਨੂੰ ਵੀ ਕੁਝ ਯਾਦ ਆਵੇ ਇਸ ਤਰ੍ਹਾਂ ਦੀਆਂ ਚੀਜ਼ਾਂ ਲ ਆਪਣੇ ਨਾਲ ਲੈ ਕੇ ਜਾਂਦੇ ਹਨ ਤਾਂ ਜੋ ਉਹਨਾਂ ਨੂੰ ਇਹ ਸੋ ਯਾਦ ਆਉਂਦੀ ਰਹੇ ਅਤੇ ਉਹ ਆਪਣੇ ਕਲਚਰ ਨਾਲ ਜੁੜੇ ਰਹਿਣ